ਸਰਕਾਰੀ ਮਤਲਬ ਕਿ ਪੰਜਾਬ ਸ ਵਿੱਚ ਮੁੱਖ ਸਰਕਾਰੀ ਨਾਗਰਿਕ ਪਰਸਪਰ ਜਿਹੜੀਆਂ ਸੇਵਾਵਾਂ ਨੇ ਬਹੁਤ ਸਾਰੀਆਂ ਮਤਲਬ ਆਸਾਨੀ ਨਾਲ਼ ਜਿਹੜੀਆਂ ਮਿਲ ਜਾਂਦੀਆਂ ਨੇ ਜਿਵੇਂ ਕਿ ਆਪਾਂ ਲਾਇਸੈਂਸ ਬਣਵਾਉਣ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਕੀ ਆ ਆਪਾਂ ਇੱਕ ਲਰਨਿੰਗ ਲਾਇਸੈਂਸ ਲਈ ਫੌਮ ਅਪਲਾਈ ਕਰਦੇ ਹਾਂ ਜਿਹੜਾ ਕਿ ਲਰਨਿੰਗ ਲਾਇਸੈਂਸ ਬਣ ਕੇ ਆ ਜਾਂਦਾ ਹੈ ਉਹ ਕੁਛ ਕੁ ਮਹੀਨਿਆਂ ਲਈ ਅਪਲਾਈ ਹੁੰਦਾ ਉਸ ਤੋਂ ਬਾਅਦ ਆਪਾਂ ਕੀ ਹੈ ਜਿਹੜਾ ਪੱਕਾ ਲਾਇਸੈਂਸ ਬਣਦਾ ਜਿਹਦੇ ਲਈ ਆਪਾਂ ਨੂੰ ਟ੍ਰਾਇਲ ਦੇਣਾ ਪੈਂਦਾ ਬਖੂਬੀ ਢੰਗ ਨਾਲ਼ ਅਤੇ ਆਪਾਂ ਕੀ ਹੈ ਉਸ ਟ੍ਰਾਇਲ ਦੇਣ ਤੋਂ ਬਾਅਦ ਆਪਣਾ ਜਿਹੜਾ ਪੱਕਾ ਲਾਇਸੈਂਸ ਬ ਮਿਲ ਜਾਂਦਾ ਆਪਾਂ ਨੂੰ ਉੱਦਾਂ ਹੀ ਕੀ ਹੈ ਪਰਮਿਟ ਮਿਲਦਾ ਆਪਾਂ ਨੂੰ ਕਈ ਸਰਟੀਫਿਕੇਟ ਨੇ ਜਿਹੜੇ ਕੱਢਵਾਉਣੇ ਹੁੰਦੇ ਮਤਲਬ ਪ੍ਰਾਪਤ ਕਰਨੇ ਹੁੰਦੇ ਉਹ ਆਪਾਂ ਪ੍ਰ ਪ੍ਰਾਪਤ ਕਰਦੇ ਹਾਂ ਇੱਦਾਂ ਹੀ ਇੱਕ ਸ਼ਿਕਾਇਤ ਦਾ ਵੀ ਮਤਲਬ ਪੰਜਾਬ ਸਰਕਾਰ ਨੇ ਇੱਕ ਮਤਲਬ ਨੰਬਰ ਜਾਰੀ ਕੀਤਾ ਹੈ ਜਿਹਦੇ ਤਹਿਤ ਆਪਾਂ ਕੀ ਹੈ ਅਗਰ ਆਪਾਂ ਨੂੰ ਕੋਈ ਵੀ ਤੰਗ ਕਰ ਰਿਹਾ ਜਾਂ ਆਪਣੇ ਤੋਂ ਮਤਲਬ ਕਿਸੇ ਤਰ੍ਹਾਂ ਦੀ ਡਿਮਾਂਡ ਕਰ ਰਿਹਾ ਤਾਂ ਆਪਾਂ ਉਸ ਨੰਬਰ 'ਤੇ ਕੀ ਹੈ ਆਪਣੀ ਇੱਕ ਛ ਛੋਟੀ ਜਿਹੀ ਵੀਡਿਓ ਬਣਾ ਕੇ ਜਾਂ ਆਪਾਂ ਉਹਨਾਂ ਨੂੰ ਫ਼ੋਨ ਕਰ ਕੇ ਇਸ ਚੀਜ਼ ਬਾਰੇ ਦੱਸ ਸਕਦੇ ਹਾਂ ਤਾਂ ਕੀ ਹੈ ਇਸ ਮਤਲਬ ਆਪਣੀ ਸ਼ਿਕਾਇਤ ਹੈ ਜਿਹੜੀ ਉਹ ਦਰਜ ਹੋ ਜਾਂਦੀ ਹੈ